ਮੇਰਾ ਮਨ ਪਸੰਦ ਗੈਜਟ ਹੈ ਮੇਰੇ ਦੋ ਮਨ ਪਸੰਦ ਗੈਜਟ ਹਨ ਇੱਕ ਮੇਰਾ ਮੋਬਾਈਲ ਫੋਨ ਅਤੇ ਇੱਕ ਮੇਰੀ ਸਮਾਟ ਵੋਚ ਮੋਬਾਇਲ ਫੋਨ ਮੇਰੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਲਾਭ ਪਹੁੰਚਾਉਂਦਾ ਹੈ ਮੋਬਾਈਲ ਫੋਨ ਨਾਲ ਮੈਂ ਆਪਣਾ ਕੰਮ ਦੇਖ ਸਕਦੀ ਹਾਂ ਕੋਈ ਵੀ ਜਿਹੜੇ ਵਟਸਐਪ ਦੇ ਵਟਸਐਪ ਦੇ ਵਿੱਚ ਮੇਰੇ ਮੈਂ ਕਿਉਂਕਿ ਕਾਲਜ ਵਿੱਚ ਪੜਾਉਂਦੀ ਹਾਂ ਉਹਦੇ ਵਿੱਚ ਜੋ ਵੀ ਵਟਸਅਪ ਦੇ ਵਿੱਚ ਮੈਨੂੰ ਮੈਸੇਜ ਆ ਜਾਂਦਾ ਹੈ ਮੇਰੀ ਕੋਈ ਡਿਊਟੀ ਲੱਗੀ ਹੈ ਕੋਈ ਵੀ ਕੰਮ ਹੈ ਫੋਨ ਦੇ ਵਿੱਚ ਹੀ ਮੇਰੇ ਘਰ ਦੇ ਸਾਰੇ ਕੈਮਰਾਜ ਹਨ ਜਿਵੇਂ ਮੇਰਾ ਛੋਟਾ ਬੱਚਾ ਹੈ ਮੈਂ ਕੈਮਰਾਜ ਦੇ ਨਾਲ ਉਹਨੂੰ ਦੇਖ ਸਕਦੀ ਹਾਂ ਕਿ ਉਹ ਇਸ ਟਾਈਮ ਕੀ ਕਰ ਰਿਹਾ ਹੈ ਖੇਡ ਰਿਹਾ ਹੈ ਸੋ ਰਿਹਾ ਹੈ ਉਹਨੇ ਖਾ ਪੀ ਲਿਆ ਉਹ ਠੀਕ ਤਾਂ ਹੈ ਨਾ ਅਤੇ ਜਿਹੜੀ ਮੇਰੀ ਸਮਾਰਟ ਵਾਚ ਹੈ ਉਹ ਮੈਨੂੰ ਫਿੱਟ ਰੱਖਣ ਵਿੱਚ ਹੈਲਪ ਰੱਖਦੀ ਹੈ ਉਹਦੇ ਨਾਲ ਮੈਂ ਤੰਦਰੁਸਤ ਰਹਿੰਦੀ ਹਾਂ ਕਿਉਂਕਿ ਉਹ ਮੈਨੂੰ ਬਾਰ ਬਾਰ ਯਾਦ ਕਰਵਾਉਂਦੀ ਹੈ ਕਿ ਮੈਂ ਇਸ ਟਾਈਮ ਪਾਣੀ ਪੀਣਾ ਹੈ ਮੈਂ ਇਸ ਟਾਈਮ ਹੁਣ ਮੇਰਾ ਐਕਸਰਸਾਈਜ਼ ਦਾ ਟਾਈਮ ਹੋ ਗਿਆ ਹੁਣ ਮੈਨੂੰ ਵਰਕਆਊਟ ਕਰਨਾ ਚਾਹੀਦਾ ਹੁਣ ਮੈਂ ਇੰਨੀਆਂ ਕੈਲੋਰੀਜ ਬਰਨ ਕਰ ਲਈਆਂ ਦਸ ਹਜ਼ਾਰ ਸਟੈਪਸ ਮੈਨੂੰ ਚੱਲਣਾ ਚਾਹੀਦਾ ਹੈ ਰੋਜ਼ ਤਾਂ ਇਸ ਨਾਲ ਇਸ ਤਰ੍ਹਾਂ ਮੇਰਾ ਮੋਬਾਇਲ ਫੋਨ ਵੀ ਅਤੇ ਮੇਰੀ ਵੋਚ ਵੀ ਮੈਨੂੰ ਬਹੁਤ ਜ਼ਿਆਦਾ ਮਦਦ ਕਰਦੇ ਹੈ ਮੇਰੇ ਰੋਜ਼ਾਨਾ ਜੀਵਨ ਵਿੱਚ ਮੈਨੂੰ ਬਹੁਤ ਜ਼ਿਆਦਾ ਲਾਭ ਪਹੁੰਚਾਉਂਦੇ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਮਦਦ ਕਰਦੇ ਹੈ